ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀ ਹੈ ਮੈਂ ਗੁਰਦਾਸਪੁਰ ਤੋਂ ਬੋਲਦੀ ਪਈ ਆ ਅੱਜ ਅਸੀਂ ਟੈਕਨੋਲੋਜੀ ਦੇ ਬਾਰੇ ਗੱਲ ਕਰਨਾ ਚਾਹੁੰਦੇ ਆਂ ਕਿਉਂਕਿ ਅੱਜ ਕੱਲ ਟੈਕਨੋਲਜੀ ਨੇ ਜਿਹੜਾ ਹੈਗਾ ਸਾਨੂੰ ਉਸਦੇ ਬਹੁਤ ਸਾਰੇ ਲਾਭ ਹੋ ਰਹੇ ਟੈਕਨੋਲਜੀ ਨਾਲ ਹਲੇ ਟਾਈਮ ਤੇ ਮਤਲਬ ਲੋਕਾਂ ਨੇ ਇੰਨੀਆਂ ਫੈਸਿਲਿਟੀਜ਼ ਨਹੀਂ ਮਿਲਦੀਆਂ ਸੀ ਇੰਨੇ ਸਾਰੇ ਲਾਭ ਮਤਲਬ ਲਾਭ ਤੋਂ ਜਿਹੜੇ ਲੋਕੀ ਜਿਹੜੇ ਆ ਵੰਚਿਤ ਰਹਿ ਜਾਂਦੇ ਸੀ ਤੇ ਜਿਹੜੇ ਲੋਕ ਅੱਜ ਕੱਲ ਕਾਫੀ ਲੋਕ ਆ ਜਿਹੜੇ ਬਾਹਰ ਚਲੇ ਜਾਂਦੇ ਹਨ ਤੇ ਉਹਨਾਂ ਨਾਲ ਮਤਲਬ ਕੋਂਟੈਕਟ ਹੀ ਚੰਗੀ ਤਰਾਂ ਹੋ ਪਾਂਦਾ ਸੀ ਅੱਗੇ ਮਤਲਬ ਵੋਇਸ ਕਾਲਿੰਗ ਹੁੰਦੀ ਸੀ ਅੱਜ ਕੱਲ ਜਿਹਦੇ ਨਾਲ ਮਤਲਬ ਵੀਡੀਓ ਕਾਲਿੰਗ ਕਰਕੇ ਵੀ ਗੱਲ ਕਰ ਸਕਦੇ ਆਂ ਫੇਸ ਟੂ ਫੇਸ ਅਸੀਂ ਦੇਖ ਸਕਦੇ ਉਹਨਾਂ ਨਾਲ ਗੱਲ ਬਾਤ ਕਰ ਸਕਦੇ ਹੈਗੇ ਆ ਤੇ ਦੂਸਰਾ ਗੱਲ ਹੈ ਕਿਸ ਤਰਾਂ ਕਾਲਜ ਦੇ ਵਿੱਚ ਵੀ ਟੈਕਨੋਲਜੀ ਨੇ ਮਤਲਬ ਉਹਦੇ ਸਾਨੂੰ ਬਹੁਤ ਸਾਰੇ ਲਾਭ ਹੁੰਦੇ ਹਨ ਅੱਜ ਕੱਲ ਬੱਚਿਆਂ ਨੂੰ ਜਿਹੜੇ ਪ੍ਰੋਜੈਕਟ ਦੇ ਕੰਮ ਕਰਨੇ ਹੁੰਦੇ ਆ ਤੇ ਉਹ ਵੀ ਮਤਲਬ ਇੱਕ ਇੰਟਰਨੈਟ ਦੁਆਰਾ ਈ ਉਹ ਆਪਣੇ ਕੰਮ ਕਰਦੇ ਹਨ ਤੇ